ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਅਸੀਂ ਟੈਕਨੋਲੋਜੀ ਦੇ ਨਾਲ ਘਿਰੇ ਹੋਏ ਹਾਂ ਤੁਸੀਂ ਜਿੱਥੇ ਵੀ ਦੇਖ ਲਓ ਟੈਕਨੋਲੋਜੀ ਤੁਹਾਨੂੰ ਹਰ ਜਗ੍ਹਾ ਮਿਲ ਜਾਵੇਗੀ ਘਰਾਂ ਦੇ ਵਿੱਚ ਬੈਂਕਾਂ ਦੇ ਵਿੱਚ ਮਾਲ ਸ਼ੋਪਿੰਗ ਮਾਲ ਦੇ ਵਿੱਚ ਹਰ ਜਗ੍ਹਾ ਇੱਥੋਂ ਤੱਕ ਲੈ ਕੇ ਤੁਸੀਂ ਬੈਂਕਾਂ ਦੇ ਵਿੱਚ ਵੀ ਦੇਖੋਗੇ ਅਤੇ ਜਦੋਂ ਅਸੀਂ ਅਕਾਊਂਟ ਖਾਤਾ ਖੁੱਲ੍ਹਵਾਉਣ ਜਾਂਦੇ ਹਾਂ ਤਾਂ ਉੱਥੇ ਵੀ ਟੈਕਨੋਲਜੀ ਦੇ ਦੁਆਰਾ ਹੀ ਸਭ ਕੁਛ ਹੁੰਦਾ ਹੈ ਕੰਪਿਊਟਰ ਹੋ ਗਏ ਏ ਟੀ ਐਮ ਦੀ ਮਸ਼ੀਨ ਹੋ ਗਈ ਇਹ ਸਭ ਕੁਛ ਜਦੋਂ ਆਪਾਂ ਖਾਤਾ ਖੁੱਲ੍ਹਵਾਉਂਦੇ ਹਾਂ ਤਾਂ ਉੱਥੇ ਸਾਡੀ ਨਿੱਜੀ ਜਾਣਕਾਰੀ ਪੁੱਛੀ ਜਾਂਦੀ ਹੈ ਜਦੋਂ ਦੁ ਦੁਬਾਰਾ ਸਾਡਾ ਖਾਤਾ ਖੋਲ੍ਹਿਆ ਜਾਂਦਾ ਹੈ

ਇਹੀ ਨਿੱਜੀ ਜਾਣਕਾਰੀ ਅੱਗੇ ਜਾ ਕੇ ਸਾਡੇ ਖਿਲਾਫ ਸਾਡੇ ਖਿਲਾਫ ਉਸਦਾ ਵਰਤਣ ਨਾ ਹੋਵੇ ਇਸ ਦਾ ਵੀ ਬੈਂਕ ਬਹੁਤ ਧਿਆਨ ਰੱਖਦੀ ਹੈ ਬਟ ਇਸਨੂੰ ਦੇਖਦੇ ਹੋਏ ਵੀ ਕਿ ਇਸਦਾ ਗਲਤ ਉਪਯੋਗ ਨਾ ਹੋਵੇ ਉਸ ਚੀਜ਼ ਦਾ ਵੀ ਬਹੁਤ ਚੰਗੀ ਤਰ੍ਹਾਂ ਨਾਲ ਧਿਆਨ ਰੱਖਿਆ ਜਾਂਦਾ ਜੋ ਵੀ ਅਸੀਂ ਵਾਈਫਾਈ ਦਾ ਜਾਂ ਇੰਟਰਨੈਟ ਦਾ ਯੂਜ ਕਰਦੇ ਹਾਂ ਇਹ ਸਾਰੀ ਜਾਣਕਾਰੀ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੱਕ ਪਹੁੰਚਾਉਣ ਲਈ ਉਹ ਸਭ ਕੁਛ